ਹੈਲੋ ਹਾਂਜੀ ਮੈਮ ਹਾਂਜੀ ਮੈਂ ਫੋਰੇਸਟ ਡਿਪਾਰਟਮੈਂਟ 'ਚ ਬੋਲ ਰਹੀ ਹਾਂ ਹਾਂਜੀ ਅਸੀਂ ਵਾਧੂ ਰੁੱਖ ਲਾਵਾਂਗੇ ਜਿਵੇਂ ਪਿ ਪਿੱਪਲ ਦਾ ਹੋ ਗਿਆ ਨਿਮ ਦਾ ਹੋ ਗਿਆ ਅਤੇ ਹੋਰ ਵੀ ਵਾਧੂ ਰੁੱਖ ਲਵਾਂਗੇ ਜਿਹਨਾਂ ਦੀ ਇਹ ਨਾਲ ਦੀ ਛਾਂ ਮਿਲਦੀ ਰਹੇ ਅਸੀਂ ਵੈਸੇ ਵੀ ਬਹੁਤ ਸ਼ਹਿਰਾਂ ਦੇ ਵਿੱਚ ਲਾਏ ਨੇ ਅਤੇ ਫਾਜ਼ਿਲਕਾ ਦੇ ਵਿੱਚ ਵੀ ਜ਼ਰੂਰ ਲਾਵਾਂਗੇ ਹਾਂਜੀ ਵੈਸੇ ਫਾਜ਼ਿਲਕਾ 'ਚ ਘੱਟ ਰੁੱਖ ਨਹੀਂ ਲੱਗੇ ਹੋਏ ਫਾਜ਼ਿਲਕਾ 'ਚ ਵੀ ਬਹੁਤ ਰੁੱਖ ਨੇ ਪਰ ਅਸੀਂ ਹੋਰ ਲਾਵਾਂਗੇ ਹਾਂਜੀ ਕਿਉਂਕਿ ਸਾਨੂੰ ਵੀ ਪਤਾ ਕੀ ਰੁੱਖਾਂ ਨਾਲ ਵਾਤਾਵਰਨ ਵਧੀਆ ਰਹਿੰਦਾ ਅਤੇ ਸਿਹਤ ਵੀ ਵਧੀਆ ਰਹਿੰਦੀ ਆ ਅਤੇ ਅਸੀਂ ਇਹਦੇ 'ਤੇ ਬਹੁਤ ਕੰਮ ਕਰ ਰਹੇ ਹਾਂ ਹਾਂਜੀ ਨਹੀਂ ਅਸੀਂ ਲਾਵਾਂਗੇ ਬਰਗਦ ਦਾ ਵੀ ਪਿੱਪਲ ਦਾ ਵੀ ਨਿੰਮ ਦਾ ਵੀ ਹੋਰ ਵੀ ਵਾਧੂ ਰੁੱਖ ਲਾਵਾਂਗੇ ਤਾਂਕਿ ਛਾਂ ਵੀ ਮਿਲਦੀ ਰਹੇ ਤੇ ਅਸੀਂ ਫੁ ਹਾਂਜੀ ਸਾਡੇ ਕਰਮਚਾਰੀ ਆਉਣਗੇ ਦੇਖਣ ਲਈ ਸਮੇਂ ਸਮੇਂ 'ਤੇ ਹਾਂਜੀ ਹਾਂਜੀ ਤੁਸੀਂ ਤੁਸੀਂ ਇਹਦੀ ਚਿੰਤਾ ਨਾ ਕਰੋ ਇਹ ਸਾਡਾ ਕੰਮ ਹੈ ਅਸੀਂ ਆਪ ਕਰਾਂਗੇ ਹਾਂਜੀ ਹਾਂਜੀ ਅਸੀਂ ਉਹ ਸਾਰਾ ਕੰਮ ਕਰਾਂਗੇ ਹਾਂਜੀ ਵੈਸੇ ਅਸੀਂ ਬਾਕੀ ਸ਼ਹਿਰਾਂ ਦੇ ਵਿੱਚ ਵੀ ਲਾਏ ਨੇ ਅਤੇ ਕੋਈ ਗੱਲ ਨਹੀਂ ਅਸੀਂ ਫਾਜ਼ਿਲਕਾ ਦੇ ਵਿੱਚ ਵੀ ਲਾਵਾਂਗੇ ਅਤੇ ਵਧੀਆ ਰਹੇਗਾ ਪਰਾਯਾਵਰਨ ਤੁਹਾਡਾ ਠੀਕ ਆ